ਪੰਜਾਬੀ ਖਾਣ ਵਾਲੀ ਚੀਜ਼ਾਂ ਦਾ ਨਾਮ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਅੰਮ੍ਰਿਤਸਰੀ ਕੁਲਚਾ ਤੰਦੂਰੀ ਰੋਟੀ ਬਟਰ ਨਾਨ ਦਾਲ ਮੱਖਣੀ ਛੋਲੇ ਭਟੂਰੇ ਪਨੀਰ ਟਿੱਕਾ ਕੜੀ ਪਕੌੜਾ ਰਾਜਮਾਂਹ ਚਾਵਲ ਬਟਰ ਚਿਕਨ ਤੰਦੂਰੀ ਚਿਕਨ ਅੰਮ੍ਰਿਤਸਰੀ ਚਿ ਮੱਛੀ ਮਟਰ ਕੜਾਹੀ ਮਿੱਠੀਆਂ ਖਾਣ ਵਾਲੀਆਂ ਚੀਜ਼ਾਂ ਜੋ ਕਿ ਪੰਜਾਬੀ ਬਹੁਤ ਪਸੰਦ ਕਰਦੇ ਹਨ ਗੁਲਾਬ ਜਾਮੁਨ ਫਿਰਨੀ ਜਲੇਬੀ ਕੜਾਹ ਪ੍ਰਸ਼ਾਦ ਲੱਸੀ ਜੋ ਕਿ ਪੀਣ ਵਾਲੀਆਂ ਹਨ ਵੀ ਲੱਸੀ ਛਾਂਚ ਕੜਾਹ ਕੜਕ ਚਾਹ ਅਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਜਿਵੇਂ ਕਿ ਭਿੰਡੀਆਂ ਲੌਕੀ ਦੀ ਸਬਜ਼ੀ ਆਦਿ ਹਨ ਅਤੇ ਹੋਰ ਕੁਲਚੇ ਬਰਗਰ ਅਤੇ ਤੰਦੂਰੀ ਰੋਟੀ ਅਤੇ ਹਨ